ਹਾਂ ਮੈਂ ਸਕੂਲ ਵਿੱਚ ਸਕੂਲ ਅਤੇ ਕਾਲਜ ਦੇ ਵਿੱਚ ਭਾਰਤੀ ਵਿਗਿਆਨੀਆਂ ਬਾਰੇ ਸਿੱਖਿਆ ਪ੍ਰਾਪਤ ਕੀਤੀ ਹੈ ਸਿੱਖਿਆ ਖੇਤਰ ਵਿੱਚ ਵਿਗਿਆਨੀਆਂ ਵਿੱਚੋ ਏ ਪੀ ਜੇ ਅਬਦੁੱਲ ਕਲਾਮ ਇੱਕ ਹਨ ਜਿਨ੍ਹਾਂ ਨੇ ਬ੍ਰਮੋਜ਼ ਮਿਸਾਈਲ ਦੀ ਖੋਜ ਕੀਤੀ ਸੀ ਜੋ ਕਿ ਬਹੁਤ ਹੀ ਤਾਕਤਵਰ ਸਿੱਧ ਹੋਈ ਹੈ ਜਿਸ ਕਰਕੇ ਭਾਰਤ ਨਾਲ ਟੱਕਰ ਲੈਣ ਤੋਂ ਅੱਜ ਹਰ ਦੇਸ਼ ਇੱਕ ਵਾਰ ਜ਼ਰੂਰ ਸੋਚਦਾ ਹੈ ਅਤੇ ਭਾਰਤੀ ਗਣਿਤ ਸ਼ਾਸਤਰ ਵਿੱਚ ਆਰਿਆ ਭੱਟ ਜਿਨ੍ਹਾਂ ਨੇ ਕਿ ਜੀਰੋ ਦੀ ਖੋਜ ਕੀਤੀ ਸੀ ਹੁਣ ਜੀਰੋ ਦੀ ਖੋਜ ਗਣਿਤ ਵਿੱਚ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਗਣਿਤ ਸ ਸ਼ੁਰੂ ਹੀ ਜੀਰੋ ਦੇ ਕਰਕੇ ਹੋਇਆ ਹੈ ਜੀਰੋ ਦੀ ਵੈਲੀਊ ਉਹੀ ਦੱਸ ਸਕਦਾ ਹੈ ਜੋ ਕਿ ਗਣਿਤ ਸ਼ਾਸਤਰੀ ਹੈ